ਸਤਿ ਸ਼੍ਰੀ ਅਕਾਲ ਮੈਮ ਮੈਂ ਪੈਸੇ ਇਨਵੈਸਟ ਕਰਨਾ ਚਾਹੁੰਦਾ ਸ਼ੇਅਰ ਮਾਰਕੀਟ 'ਚ ਅਤੇ ਤੁਸੀਂ ਮੈਨੂੰ ਕੁੱਛ ਦੱਸ ਸਕਦੇ ਹੋ ਦੋ ਚਾਰ ਮੇਰੇ ਨਾਲ ਵੀ ਸਾਂਝੀਆਂ ਕਰੋ ਸ਼ੇਅਰ ਮਾਰਕੀਟ ਓਕੇ ਹਾਂਜੀ ਹਾਂਜੀ ਓਕੇ ਦੱਸੋ ਦੱਸੋ ਦੱਸੋ ਡੀਮੈਟ ਅਕਾਊਂਟ ਬਾਰੇ ਹਾਂਜੀ ਹਾਂਜੀ ਹਾਂਜੀ ਹਾਂਜੀ ਨਹੀਂ ਨਹੀਂ ਹੋਰ ਇਨਫਰਮੇਸ਼ਨ ਦਓ ਓਕੇ ਓਕੇ ਓਕੇ ਓਕੇ ਮੈਮ ਥੈਂਕਸ ਯੂ ਜੇ ਕੋਈ ਹੋਰ ਇਨਫਰਮੇਸ਼ਨ ਚਾਹੀਦੀ ਹੋਈ ਤੁਹਾਨੂੰ ਫਿਰ ਕੋਲ ਕਰਾਂਗੇ ਥੈਂਕਸ